ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਆਪਣੇ ਔਲਾ ਕੈਬ ਤੋਂ ਕੈਬ ਬੁੱਕ ਕੀਤੀ ਸੀਗੀ ਜੀ ਅਤੇ ਉਹਦੇ ਵਿੱਚ ਤੁਹਾਡਾ ਨੰਬਰ ਗੱਡੀ ਨੰਬਰ ਸ਼ੋਅ ਹੋ ਰਿਹਾ ਗਾ ਪੀ ਬੀ ਪੈਂਹਠ ਬੀ ਸੀ ਚੁਰਾਨਵੇਂ ਪੈਂਤੀ ਨਾਮ ਸ ਡਰਾਈਵਰ ਨੇਮ ਸੁੱਖੀ ਹੈ ਅਤੇ ਤੁਸੀਂ ਹੁਣ ਕਿੱਥੇ ਖੜ੍ਹੇ ਹੋ ਜੀ ਬਠਿੰਡੇ ਬਠਿੰਡੇ ਨਹੀਂ ਵੀਰ ਜੀ ਤੁਸੀਂ ਨਾ ਆਪਣਾ ਮੇਰੇ ਪਿੰਡ ਭਾਗੂ ਆਉਣਾ ਜੀ ਭਾਗੂ ਆਪਣੇ ਬਠਿੰਡੇ ਤੋਂ ਬਾਰ੍ਹਾਂ ਕਿਲੋਮੀਟਰ ਅੱਗੇ ਹੈ ਜੀ ਅੰਡਰਬ੍ਰਿਜ ਨਿਕਲੋਗੇ ਨਾ ਜੱਸੀ ਚੌਕ ਆਊਗਾ ਜੱਸੀ ਚੌਕ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਨਾ ਖੱਬੇ ਹੱਥ ਰੋਡ ਨਿਕਲ ਕੇ ਮੇਨ ਬਠਿੰਡਾ ਬਰਨਾਲਾ ਰੋਡ 'ਤੇ ਮੇਰਾ ਪਿੰਡ ਭਾਗੂ ਆ ਬਾਰ੍ਹਾਂ ਕਿਲੋਮੀਟਰ ਬਠਿੰਡੇ ਤੋਂ ਤੁਸੀਂ ਬਿਲਕੁਲ ਉਹ ਰੋਡ ਲੈਣਾ ਗਾ ਲਿੰਕ ਰੋਡ ਹੈਗਾ ਗਾ ਅਤੇ ਤੁਹਾਨੂੰ ਉਹ ਸਹੀ ਜਗ੍ਹਾ 'ਤੇ ਲੈ ਆਊਗਾ ਜਦੋਂ ਤੁਸੀਂ ਮੇਰੇ ਪਿੰਡ ਪਹੁੰਚ ਜੋਗੇ ਨਾ ਪਿੰਡ ਪਹੁੰਚ ਕੇ ਤੁਸੀਂ ਇੱਕ ਵਾਰੀ ਕੌਲ ਕਰ ਲਿਓ ਮੇਰੇ ਪਿੰਡ ਤੋਂ ਤੁਹਾਨੂੰ ਮੈਂ ਦੱਸ ਦੂੰਗਾ ਤੁਸੀਂ ਮੇਰੇ ਪਿੰਡ ਜਦੋਂ ਐਂਟਰ ਕਰੋਗੇ ਬਿਲਕੁਲ ਤੁਸੀਂ ਆਪਣਾ ਖੱਬੇ ਹੱਥ ਗੱਡੀ ਲੈਣੀ ਆ ਬਿਲਕੁਲ ਫਿਰਨੀ ਫਿਰਨੀ ਆ ਕੇ ਅੱਗੇ ਮੇਰਾ ਨਾ ਬਿਲਕੁਲ ਸਟੇਸ਼ਨ ਬਾਇਕ ਦਾ ਰਸਤਾ ਸਟ ਸਟੇਸ਼ਨ ਵੱਲ ਨਿਕਲ ਜਾਂਦਾ ਸਟੇਸ਼ਨ ਵੱਲ ਨਹੀਂ ਜਾਣਾ ਤੁਸੀਂ ਬਿਲਕੁਲ ਫਿਰਨੀ ਆ ਕੇ ਅੱਗੇ ਨਾ ਇੱਕ ਆਟਾ ਚੱਕੀ ਲੱਗੀ ਹੋਈ ਆ ਆਟਾ ਚੱਕੀ ਦੇ ਨਾਲ ਹੀ ਬਿਲਕੁਲ ਆਪਣਾ ਘਰ ਆ ਗਾ ਬਾਕੀ ਜੇ ਕੋਈ ਤੁਹਾਨੂੰ ਦਿੱਕਤ ਆਈ ਤਾਂ ਤੁਸੀਂ ਮੇਰੇ ਨਾਲ ਫੋਨ 'ਤੇ ਗੱਲ ਕਰ ਲਿਓ ਅਤੇ ਮੈਂ ਤੁਸੀਂ ਮਾੜਾ ਜਿਹਾ ਟਾਈਮ ਸਿਰ ਪਹੁੰਚ ਜਿਓ ਵੀਰੇ ਮੈਂ ਨਾ ਬਹੁਤ ਜ਼ਿਆਦਾ ਲੇਟ ਹੋ ਰਿਹਾ ਮੈਂ ਫੰਕਸ਼ਨ ਅਟੈਂਡ ਕਰਨਾ ਗਾ ਨਾਲ ਫੈਮਲੀ ਲੈ ਕੇ ਜਾਣੀ ਹੈ